ਮੇਰਾ ਪਸੰਦੀਦਾ ਮੌਸਮ ਸਰਦੀਆਂ ਦਾ ਹੈ ਇਸਦਾ ਕਾਰਨ ਇਹ ਹੈ ਕਿ ਸਰਦੀਆਂ ਦੇ ਵਿੱਚ ਅਸੀਂ ਧੁੱਪ ਸੇਕ ਸਕਦੇ ਹਾਂ ਅਤੇ ਡ ਵਿਟਾਮਿਨ ਡੀ ਪ੍ਰਾਪਤ ਕਰ ਸਕਦੇ ਹਾਂ